ਮੈਂ ਸੋਸ਼ਲ ਮੀਡੀਆ ਤੇ ਫੇਸਬੁਕ ਤੇ ਇੰਸਟਾਗ੍ਰਾਮ ਚਲਾਉਣੀ ਹਾਂ ਜਿਸ ਤੇ ਮੈਂ ਆਪਣੀ ਅਤੇ ਆਪਣੇ ਫੈਮਲੀ ਨਾਲ ਪਿੱਕ ਅਪਲੋਡ ਕਰਦੀ ਰਹਿੰਦੀ ਹਾਂ ਅਸਲ ਦੇ ਵਿੱਚ ਸੋਸ਼ਲ ਮੀਡੀਆ ਸਾਡੀ ਬਹੁਤ ਤਰ੍ਹਾਂ ਨਾਲ ਮਦਦ ਵੀ ਕਰਦਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਣੇ ਜੋ ਰਿਸ਼ਤੇਦਾਰ ਜਾਂ ਸਕੂਲ ਫਰੈਂਡ ਹੁੰਦੇ ਆ ਉਹਨਾਂ ਦੀ ਕੋਂਟੈਕਟ ਵੀ ਆਪਣੇ ਕੋਲ ਨਹੀਂ ਹੁੰਦੇ ਪਰ ਇੱਕ ਸੋਸ਼ਲ ਮੀਡੀਆ ਇਹੋ ਜਿਹਾ ਜਰੀਆ ਜਿਸ ਰਾਹੀਂ ਆਪਾਂ ਉਹਨਾਂ ਨੂੰ ਮਿਲ ਸਕਦੇ ਹਾਂ ਤੇ ਉਹਨਾਂ ਦੀ ਕੋਂਟੈਕਟ ਲੈ ਸਕਦੇ ਹਾਂ ਮੈਂ ਹਮੇਸ਼ਾ ਹੀ ਆਪਣੀ ਜਿਹੜੀ ਪ੍ਰੋਫਾਈਲ ਆ ਉਸ ਨੂੰ ਲੋਕ ਵਿੱਚ ਰੱਖਦੀ ਹਾਂ ਕਿਉਂਕਿ ਸੋਸ਼ਲ ਮੀਡੀਆ ਜਿੰਨਾ ਪ੍ਰਫੁੱਲਤ ਹੈ ਉਨਾਂ ਲੋਕ ਇਸਦਾ ਗਲਤ ਇਸਤੇਮਾਲ ਵੀ ਕਰ ਰਹੇ ਹਨ ਇਸ ਕਰਕੇ ਮੈਂ ਆਪਣੀ ਪ੍ਰੋਫਾਈਲ ਲੋਕ ਚ ਰੱਖਦੀਆਂ ਕਿ ਕੋਈ ਇਸਦਾ ਗਲਤ ਇਸਤੇਮਾਲ ਨਾ ਕਰ ਸਕੇ